ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਬਹੁਤ ਸਾਰੀਆਂ ਭਲਾਈ ਅਤੇ ਵਿਕਾਸ ਪ੍ਰੋਗਰਾਮ ਆਦਿ ਕੀਤੇ ਜਾਂਦੇ ਹਨ ਜਿਵੇਂ ਕਿ ਸਿੱਖਿਆ ਵਿੱਚ ਵਾਧਾ ਜਿਵੇਂ ਕਿ ਯੂਨੀਵਰਸਿਟੀਆਂ ਕੋਲਜ ਆਦਿ ਵਧੀਆ ਕਿੱਤੇ ਹਨ ਅਤੇ ਔਰਤਾਂ ਦਾ ਸ਼ਕਤੀਕਰਨ ਔਰਤਾਂ ਦੀ ਸ਼ਕਤੀਕਰਨ ਲਈ ਥਾਂ ਥਾਂ ਪ੍ਰੋਗਰਾਮ ਲਾਏ ਜਾਂਦੇ ਹਨ ਤਾਂ ਜੋ ਔਰਤਾਂ ਨੂੰ ਜਾਗਰੂਕ ਕੀਤਾ ਜਾ ਸਕੇ ਸਿਹਤ ਦੇ ਦੇਖਭਾਲ ਅਤੇ ਹਸ ਸਰਕਾਰ ਲਈ ਸਰਕਾਰੀ ਹਸਪਤਾਲ ਵਿੱਚ ਬਹੁਤ ਸਹੂਲਤਾਂ ਹਨ ਅਤੇ ਸ ਰੁਜ਼ਗਾਰ ਦੇ ਸਾਧਨਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ ਬਹੁਤ ਸਾਰੀਆਂ ਨਵੀਆਂ ਇੰਡਸਟਰੀਜ਼ ਲਗਾਈਆਂ ਹਨ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਜ਼ ਦਿੱਤੀਆਂ ਜਾਂਦੀਆਂ ਹਨ ਜੋ ਗਰੀਬ ਅਤੇ ਬੇਰੁਜ਼ਗਾਰ ਨੌਜਵਾਨ ਉਹਨਾਂ ਦਾ ਫਾਇਦਾ ਲੈ ਸਕਦੇ ਹਨ ਸਕੀਮਜ਼ ਹੁੰਦੀਆਂ ਜਿਹੜੀਆਂ ਜਿਵੇਂ ਡਰੱਗ ਅਬਿਊਜ਼ਨ ਇਸ ਵਿੱਚ ਜੋ ਜਿਹੜੇ ਬੱਚੇ ਨਸ਼ੇ ਕਰਦੇ ਹਨ ਉਹਨਾਂ ਨੂੰ ਨਸ਼ਿਆਂ ਉਹਨਾਂ ਨੂੰ ਨਸ਼ਿਆਂ ਪ੍ਰਤੀ ਉਹਨਾਂ ਦਾ ਧਿਆਨ ਹਟਾ ਕੇ ਅਤੇ ਵੱਖ ਵੱਖ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਹਨ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਫਰੀ ਦਿੱਤਾ ਜਾਂਦਾ ਹੈ ਤਾਂ ਕਿ ਉਹ ਖੇਡਾਂ ਵੱਲ ਧਿਆਨ ਦੇਣ ਅਤੇ ਨਸ਼ਿਆਂ ਵੱਲ ਨਾ ਬੀਬੀ ਬੀਬੀ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਇਹ ਦੋ ਹਜ਼ਾਰ ਗਿਆਰ੍ਹਾਂ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੇਸ਼ ਕੀਤੀ ਗਈ ਸੀ ਇਹ ਸਕੀਮ ਇਹ ਸਕੀਮ ਇਹ ਸਕੀਮ ਪ੍ਰਦਾਨ ਕਰਦੇ ਸਮੇਂ ਬੱਚਿਆਂ ਦੀ ਸਰ ਸਰ ਸ ਬੱਚਿਆਂ ਦੀ ਸਿੱਖਿਆ ਲਈ ਯੋਜ ਯੋਗ ਪਰਿਵਾਰਾਂ ਨੂੰ ਇੱਕਾਹਠ ਹਜ਼ਾਰ ਰੁਪਏ ਦਿੱਤੇ ਗਏ ਅਤੇ ਇੱਕ ਹੈਗੀ ਸਕੀਮ ਸਕੋਲਰਸ਼ਿਪ ਆਫ ਸਟੂਡੈਂਟਸ ਇਸ ਵਿੱਚ ਇੰਡ ਇਹ ਇੰਡੀਆ ਵਿੱਚ ਲਾਂਚ ਹੋਈ ਸੀ ਇਸ ਵਿੱਚ ਸਟੂਡੈਂਟਸ ਨੂੰ ਜਿਸ ਸਟੂਡੈਂਟਸ ਦੇ ਪੇਰੈਂਟਸ ਦੀ ਇਨਕਮ ਹੈਗੀ ਹੈ ਨਾ ਦਸ ਹਜ਼ਾਰ ਤੋਂ ਘੱਟ ਹੈ ਉਸਨੂੰ ਸਕਾਲਰਸ਼ਿਪ ਲੱਗਦੀ ਹੈ ਇਹ ਸਕੀਮਾਂ ਇਹ ਸਕੀਮਾਂ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜ਼ਿਲ੍ਹੇ ਵਿੱਚ ਇਹਨਾਂ ਦੀ ਸੇਵਾਵਾਂ ਮਿਲਦੀ ਹੈ